ਖਾਣ ਪੀਣ ਵਿੱਚ ਮੇਰਾ ਸਭ ਤੋਂ ਵੱਧ ਮਨਪਸੰਦ ਦਾ ਖਾਣਾ ਪੀਣਾ ਜੋ ਕਿ ਘਰ ਦਾ ਬਣਿਆ ਹੋਇਆ ਹੋਣਾ ਚਾਹੀਦਾ ਹੈ ਉਹ ਹੈ ਅਤੇ ਪਰਿਵਾਰ ਨਾਲ ਬੈਠ ਕੇ ਜੋ ਸਭ ਕੁਝ ਖਾਣ ਲਈ ਮਿਲਦਾ ਹੈ ਉਹ ਸਭ ਤੋਂ ਵੱਧ ਆਨੰਦ ਮਾਣ ਕੇ ਖਾਇਆ ਜਾਂਦਾ ਹੈ